ਮੇਰਾ ਨਾਮ ਰਿਹਾਨ ਹੈ ਮੈਨੂੰ ਡਾਂਸ ਕਰਨ ਦਾ ਬਹੁਤ ਸ਼ੌਂਕ ਹੈ ਮੈਂ ਆਪਣਾ ਕਰੀਅਰ ਡਾਂਸ ਵਿੱਚ ਬਣਾਉਣਾ ਚਾਹੁੰਦਾ ਸੀ ਮੈਂ ਇੱਕ ਦਿਨ ਡਾਂਸ ਸ਼ੋਅ ਜਿੱਤਣ ਲਈ ਇੱਕ ਸ਼ਹਿਰ ਵਿੱਚ ਗਿਆ ਸੀ ਮੈਂ ਆਪਣਾ ਡਾਂਸ ਬਹੁਤ ਵਧੀਆ ਕੀਤਾ ਸੀ ਅਤੇ ਅਚਾਨਕ ਹੀ ਮੈਨੂੰ ਘਰ ਵਿੱਚ ਫੋਨ ਆਉਂਦਾ ਹੈ ਕਿ ਮੇਰੇ ਪਾਪਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਅਤੇ ਮੈਨੂੰ ਘਰ ਵਿੱਚ ਵਾਪਿਸ ਬੁਲਾਇਆ ਗਿਆ ਹੈ ਮੇਰੇ ਅੱਗੇ ਮੇਰਾ ਕਰੀਅਰ ਸੀ ਅਤੇ ਇੱਕ ਪਾਸੇ ਮੇਰਾ ਪਰਿਵਾਰ ਸੀ ਅਤੇ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਸਨ ਜੋ ਕਿ ਮੈਂ ਆਪਣੇ ਪਿਤਾ ਦਾ ਇਲਾਜ ਕਰਵਾ ਸਕਾ ਮੈਂ ਛੁੱਟੀਆਂ ਲੈ ਕੇ ਘਰ ਵਾਪਿਸ ਚਲਾ ਗਿਆ ਅਤੇ ਮੈਂ ਘਰ ਜਾ ਕੇ ਆਪਣੇ ਪਿਤਾ ਦਾ ਇਲਾਜ ਕਰਵਾਇਆ ਅਤੇ ਮੈਂ ਪੈਸੇ ਵੀ ਉਧਾਰ ਲਏ ਸਨ ਜਿਸ ਕਰਕੇ ਮੇਰੇ ਉੱਤੇ ਕਰਜ਼ੇ ਦਾ ਬੋਝ ਸੀ ਇਸ ਕਰਕੇ ਮੈਂ ਬਹੁਤ ਪਰੇਸ਼ਾਨ ਰਹਿਣ ਲੱਗਿਆ ਇਹ ਘਟਨਾ ਮੇਰੀ ਡਾਂਸ ਕਰੀਅਰ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ ਅਤੇ ਮੈਂ ਕਿਸੇ ਤੋਂ ਪੈਸੇ ਵੀ ਉਧਾਰ ਨਹੀਂ ਮੰਗ ਸਕਦਾ ਸੀ ਅਤੇ ਮੇਰਾ ਸਫ਼ਰ ਚੁਣੌਤੀਆਂ ਭਰਿਆ ਰਿਹਾ ਜਿਸ ਕਰਕੇ ਮੈਨੂੰ ਬਹੁਤ ਦਿੱਕਤ ਅਤੇ ਪਰੇਸ਼ਾਨੀ ਭਰਿਆ ਸਫ਼ਰ ਗੁਜ਼ਾਰਨਾ ਪਿਆ ਮੈਂ ਫਿਰ ਆਪਣੇ ਇੱਕ ਘਰ ਦੇ ਕਿਸੇ ਮੈਂਬਰ ਕੋਲ ਨਹੀਂ ਗਿਆ ਤੇ ਅਤੇ ਉਹਨਾਂ ਤੋਂ ਪੈਸੇ ਉਧਾਰ ਲਏ ਜਿਸ ਕਰਕੇ ਮੇਰੇ ਪਿਤਾ ਦਾ ਇਲਾਜ ਕਰਵਾਇਆ ਗਿਆ ਅਤੇ ਮੈਂ ਉਸ ਨੂੰ ਆਪਣੇ ਪਿਤਾ ਨਾਲ ਲਿਜਾ ਕੇ ਆਪਣੇ ਪੈਸਿਆਂ ਨਾਲ ਉਸਦਾ ਇਲਾਜ ਕਰਵਾਇਆ ਅਤੇ ਉਹਨਾਂ ਨੂੰ ਦੁਬਾਰਾ ਘਰ ਵਿੱਚ ਲਿਜਾ ਕੇ ਆਪਣਾ ਡਾਂਸ ਸ਼ੋਅ ਵਿੱਚ ਚਲਾ ਗਿਆ ਉੱਥੇ ਮੈਂ ਆਪਣਾ ਹਰ ਦਿਨ ਹਰ ਰੋਜ਼ ਡਾਂਸ ਪਰਫੋਰਮਸ ਬਹੁਤ ਵਧੀਆ ਦਿੱਤੀ ਅਤੇ ਜਿਸ ਨਾਲ ਮੈਂ ਆਪਣੇ ਡਾਂਸ ਕਰੀਅਰ ਵਿੱਚ ਅੱਗੇ ਆਇਆ ਅਤੇ ਜੱਜ ਸਾਹਿਬਾਨ ਨੇ ਮੈਨੂੰ ਬਹੁਤ ਵਧੀਆ ਨੰਬਰ ਦਿੱਤੇ ਜਿਹਨਾਂ ਕਰਕੇ ਮੈਂ ਫਸਟ ਪੁਜ਼ੀਸ਼ਨ ਲੈ ਕੇ ਆਇਆ ਅਤੇ ਮੈਂ ਸਾਰੇ ਪਿੰਡ ਵਿੱਚ ਮੇਰਾ ਨਾਂ ਲਿੱਤਾ ਗਿਆ ਅਤੇ ਮੈਂ ਆਪਣੇ ਡਾਂਸ ਕਰੀਅਰ ਵਿੱਚ ਸਭ ਤੋਂ ਫਸਟ ਪੁਜ਼ੀਸ਼ਨ 'ਤੇ ਆਇਆ ਅਤੇ ਇਸ ਬਾਰੇ ਨਿਊਜ਼ 'ਚ ਵੀ ਨਾਮ ਆਇਆ ਗਿਆ ਸੀ ਅਤੇ ਜਿਸ ਕਰਕੇ ਮੈਨੂੰ ਬਹੁਤ ਵੱਡੀ ਰਾਸ਼ੀ ਦਿੱਤੀ ਗਈ ਅਤੇ ਜਿਸ ਨਾਲ ਮੈਂ ਆਪਣੇ ਪਿਤਾ ਦਾ ਇਲਾਜ ਕਰਵਾਇਆ ਅਤੇ ਜਿਹਨਾਂ ਤੋਂ ਮੈਂ ਪੈਸੇ ਲਏ ਸਨ ਅਤੇ ਉਹਨਾਂ ਨੂੰ ਵਾਪਿਸ ਕੀਤੇ ਅਤੇ ਹੁਣ ਮੇਰਾ ਦੁਨੀਆਂ ਭਰ ਵਿੱਚ ਨਾਂ ਆਇਆ ਅਤੇ ਮੈਂ ਹੁਣ ਡਾਂਸ ਸ਼ੋਅ ਵਿੱਚ ਆਪਣਾ ਕੈਰੀਅਰ ਬਣਾ ਚੁੱਕਾ ਹਾਂ